ਰਾਮ ਰਾਮ ਜੀ ਮੈਡਮ ਮੈਂ ਤੁਹਾਡੇ ਤੋਂ ਇੱਕ ਤੁਸੀਂ ਟੇਲਰ ਬੋਲ ਰਹੇ ਹੋ ਨਾ ਪਰਮਜੀਤ ਟੇਲਰ ਹਾਂਜੀ ਮੈਡਮ ਮੈਂ ਤੁਹਾਡੇ ਤੋਂ ਨਾ ਡਰੈੱਸ ਸੁਆਣੀ ਸੀ ਜੀ ਮੇਰੇ ਬ੍ਰਦਰ ਦੀ ਮੈਰਿਜ ਹੈ ਅਤੇ ਮੈਨੂੰ ਅੱਜ ਕੱਲ੍ਹ ਕੀ ਟਰੈਂਡਿੰਗ 'ਚ ਚੱਲ ਰਿਹਾ ਹੈ ਮੈਨੂੰ ਜ਼ਰਾ ਦੱਸੋਂਗੇ ਅੱਛਾ ਜੀ ਅੱਛਾ ਜੀ ਅੱਛਾ ਜੀ

ਅੱਛਾ ਜੀ ਅਤੇ ਮੈਡਮ ਮਤਲਬ ਚਾਰ ਪੰਜ ਸੂਟ ਸਵਾਣੇ ਚਾਰ ਪੰਜ ਫੰਕਸ਼ਨ ਹੈਗੇ ਹੈ ਨਾ ਜਿੱਦਾਂ ਅਤੇ ਮੈਂ ਕਿੱਦਾਂ ਕਿਹੜੇ ਫੰਕਸ਼ਨ 'ਚ ਕੀ ਸਵਾਵਾਂ ਅੱਛਾ ਜੀ ਨਹੀਂ ਜਾਗੋ ਵਾਸਤੇ ਵੈਸੇ ਪੰਜਾਬੀ ਸੂਟ ਨਹੀਂ ਸਹੀ ਰਹੇਗਾ ਹਾਂਜੀ ਔਰ ਸੂਟ ਪਾਉਣਾ ਕਿ ਲਹਿੰਗਾ ਵਧੀਆ ਲੱਗੇਗਾ ਉਹ ਸ਼ਰਾਰਾ ਅੱਛਾ ਜੀ ਔਰ ਹਲਦੀ ਵਾਲ਼ੇ ਦਿਨ ਯੈਲੋ ਕਲਰ ਹੈ ਨਾ ਸਹੀ ਲੱਗੇਗਾ ਨਾ ਅੱਛਾ ਜੀ ਅਤੇ ਬਰਾਤ ਵਾਲ਼ੇ ਦਿਨ ਬਰਾਤ ਵਾਲ਼ੇ ਦਿਨ ਹਮ ਠੀਕ ਹੈ ਜੀ ਠੀਕ ਹੈ ਚਲੋ ਫ਼ਿਰ ਤੁਹਾਡਾ ਹਾਂਜੀ ਕਿੱਥੇ ਤੱਕਰ ਤੁਹਾਡਾ ਮਤਲਬ ਕਿ ਵਿਆਹ ਤਾਂ ਜੀ ਹਜੇ ਪਿਆ ਪੰਦਰ੍ਹਾਂ ਵੀਹ ਦਿਨ ਪਏ ਹੈ ਹਜੇ ਹਾਂਜੀ ਅਤੇ ਮੈਨੂੰ ਥੋੜ੍ਹਾ ਹਾਂਜੀ ਤਾਂ ਹੀ ਮੈਂ ਮੈਨੂੰ ਵੀ ਕਿਸੀ ਨੇ ਸਜੇਸਟ ਕੀਤਾ ਸੀ ਨਾ ਮੈਂ ਤਾਂ ਹੀ ਤੁਹਾਨੂੰ ਫ਼ੋਨ ਕੀਤਾ ਕੀ ਜੇ ਟਾਈਮ ਸਿਰ ਬਣ ਜੇਗਾ ਫ਼ੇਰ ਵਧੀਆ ਹੈ ਨਾ ਹਾਂਜੀ ਹਾਂਜੀ ਅਤੇ ਕਿੱਥੇ ਤੁਹਾਡੀ ਸ਼ੋਪ ਕਿੱਥੇ ਆ ਠੀਕ ਹੈ ਜੀ ਚਲੋ ਮੈਂ ਆਉਣ ਤੋਂ ਪਹਿਲੇ ਨਾ ਤੁਹਾਨੂੰ ਫ਼ਿਰ ਕੋਲ ਕਰ ਲੂੰਗੀ ਨਾਲ਼ੇ ਮੈਂ ਤੁਹਾਨੂੰ ਕੱਪੜਾ ਦਿਖਾ ਜਾਊਂਗੀ ਨਾਲ਼ੇ ਡਿਜ਼ਾਈਨ ਸਿਲੈਕਟ ਕਰ ਲਾਂਗੇ ਹਾਂਜੀ ਹਾਂਜੀ ਹਾਂ ਹਾਂ ਠੀਕ ਠੀਕ ਹੈ ਜੀ ਮੈਂ ਤਾਂ ਹੀ ਕਹਿ ਰਹੀ ਨਾ ਮੈਂ ਕਾ ਨਾਲ਼ੇ ਮਤਲਬ ਗਲਾ ਹੋ ਗਿਆ ਡਿਜ਼ਾਈਨ ਹੋ ਗਿਆ ਆਪਾਂ ਇੱਕ ਦੂਸਰੇ ਕੋਲ਼ ਦੇਖ ਕੇ ਸਿਲੈਕਟ ਕਰ ਲਾਂਗੇ ਥੋੜ੍ਹੇ ਜਿਹੇ ਫ਼ੋਨ 'ਚ ਵੀ ਵੇਖ ਲਾਂਗੇ ਚਲੋ ਠੀਕ ਹੈ ਧੰਨਵਾਦ ਜੀ ਓਕੇ